ਸਿਹਤ ਸੰਭਾਲ ਨੂੰ ਬਿਹਤਰ ਬਣਾਉਣ ਲਈ ਸਾਡੇ ਸੁਝਾਅ ਇਹ ਹਨ ਕਿ ਸਾਡੇ ਪਿੰਡ ਵਿੱਚ ਹਸਪਤਾਲ ਖੁੱਲ੍ਹੇ ਹੋਣੇ ਚਾਹੀਦੇ ਹਨ ਜਾਂ ਡਿਸਪੈਂਸਰੀ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਵਧੀਆ ਦਵਾਈਆਂ ਮੁਹੱਈਆ ਹੋ ਸਕਣ ਅਤੇ ਲੋਕਾਂ ਨੂੰ ਦੂਰ ਜਾਣ ਦੀ ਲੋੜ ਵੀ ਨਾ ਪਵੇ ਸਿਹਤ ਨੂੰ ਠੀਕ ਰੱਖਣ ਲਈ ਸਾਨੂੰ ਆਲੇ ਦੁਆਲੇ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਤਾਜ਼ੀ ਹਵਾ ਸਾਹ ਲੈਣ ਲਈ ਆਕਸੀਜਨ ਠੰਢੀ ਛਾਂ ਮਿਲ ਸਕੇ ਇਸ ਤਰ੍ਹਾਂ ਲੋਕ ਬਿਮਾਰ ਵੀ ਘੱਟ ਹੋਣਗੇ ਅਤੇ ਜਨਤਾ ਨੂੰ ਚਾਹੀਦਾ ਹੈ ਕਿ ਪ੍ਰਦੂਸ਼ਣ ਵੀ ਘੱਟ ਫੈਲਾਉਣ ਪ੍ਰਦੂਸ਼ਣ ਧੂੰਏਂਂ ਦਾ ਹੁੰਦਾ ਹੈ ਜੋ ਸਾਹ ਲੈਣ ਵਿੱਚ ਕਾਫੀ ਦਿੱਕਤ ਹੁੰਦੀ ਹੈ ਇਸ ਤਰ੍ਹਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ ਪਾਣੀ ਦਾ ਪ੍ਰਦੂਸ਼ਣ ਵੀ ਹੁੰਦਾ ਹੈ ਲੋਕ ਵਰਤੋਂ ਤੋਂ ਜ਼ਿਆਦਾ ਪਾਣੀ ਵਰਤਦੇ ਅਤੇ ਇਹ ਗੰਦਾ ਕਰਦੇ ਹਨ ਲੋਕਾਂ ਨੂੰ ਚਾਹੀਦਾ ਹੈ ਪਾਣੀ ਦੇ ਪਾਣੀ ਘੱਟ ਗੰਦਾ ਕਰਨ ਅਤੇ ਸੰਭਾਲ ਨਾਲ ਵਰਤਣ ਪ੍ਰਦੂਸ਼ਣ ਵੀ ਰੁਕ ਸਕਦਾ ਹੈ ਇਸ ਤਰ੍ਹਾਂ ਹੀ ਸਿਹਤ ਸੰਭਾਲ ਹੋ ਸਕਦੀ ਹੈ